ਸਕੂਲਾਂ ਵਿੱਚ ਕਈ ਤਰ੍ਹਾਂ ਦੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ ਜਿਵੇਂ ਕਿ ਕਈ ਤਰ੍ਹਾਂ ਦੇ ਮੁਕਾਬਲੇ ਭਾਸ਼ਾ ਮੁਕਾਬਲਾ ਕਵਿਤਾਵਾਂ ਦੇ ਮੁਕਾਬਲੇ ਨਾਟਕ ਮੁਕਾਬਲੇ ਅਤੇ ਦੀਵਾਲੀ ਦੇ ਕੋਲ ਰੰਗੋਲੀ ਦੇ ਮੁਕਾਬਲੇ ਜਾਂ ਸਾਇੰਸ ਫੇਅਰ ਵੀ ਕੀਤੇ ਜਾਂਦੇ ਹਨ ਇਸ ਤੋਂ ਬਾਅਦ ਸਕੂਲਾਂ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਵੀ ਸਿਖਾਈਆਂ ਜਾਂਦੀਆਂ ਹਨ ਜਿਵੇਂ ਕਿ ਹੈਂਡਬੋਲ ਵੋਲੀਬੋਲ ਬਾਸਕਿਟਬੋਲ ਬੈਡਮਿੰਟਨ ਜਾਂ ਗਤਕਾ ਵੀ ਸਿਖਾਈਆਂ ਜਾਂਦੀਆਂ ਹਨ ਇਹਨਾਂ ਵਿੱਚ ਮੈਂ ਸਪੋਰਟਸ ਮੀਟ ਦੇ ਦੌਰਾਨ ਸੋਲਾਂ ਸੌ ਮੀਟਰ ਅਥਲੀਟ ਦੀ ਰੇਸ ਵਿੱਚ ਹਿੱਸਾ ਲਿਆ ਜਿਸ ਵਿੱਚ ਮੈਂ ਗੋਲਡ ਮੈਡਲ ਜਿੱਤਿਆ ਸੀ